ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਜੀ ਹੋਰ ਸੁਣਾਓ ਕੀ ਹਾਲ ਚਾਲ ਮੈਂ ਨਾ ਰੋਹਨ ਦੀ ਮੰਮਾ ਬੋਲਦੀ ਪਈ ਹਾਂ ਹਾਂਜੀ ਤੁਹਾਡੇ ਮਤਲਬ ਮੁੰਡੇ ਦੇ ਮੁੰਡੇ ਦਾ ਹੀ ਫਰੈਂਡ ਆ ਮੇਰਾ ਮੁੰਡਾ ਅਤੇ ਹਾਂਜੀ ਉਹ ਇੱਥੇ ਪਾਰਕ 'ਚ ਖੇਡਦੇ ਟਾਈਮ ਮਿਲੇ ਸੀ ਹਾਂਜੀ ਅਤੇ ਹੁਣ ਉਹ ਨਾ ਥੋ ਵੱਡਾ ਹੋ ਗਿਆ ਵਾ ਅਤੇ ਮੈਂ ਸੋਚਦੀ ਪਈ ਹਾਂ ਮਤਲਬ ਸਕੂਲ ਪਾਉਣ ਦੀ ਉਹ ਨੂੰ ਅਤੇ ਹਜੇ ਅਸੀਂ ਇੱਥੇ ਨਿਊ ਹੀ ਆਏ ਹਾਂ ਥੋੜ੍ਹੇ ਟਾਈਮ ਪਹਿਲਾਂ ਹਾਂਜੀ ਅਤੇ ਮੈਨੂੰ ਇੱਥੋਂ ਦੇ ਸਕੂਲ ਦਾ ਇੰਨਾ ਪਤਾ ਨਹੀਂ ਆ ਸਕੂਲ ਦੇ ਬਾਰੇ ਕੀ ਵਧੀਆ ਐਜੂਕੇਸ਼ਨ ਕਿੱਥੇ ਆ ਹੋਰ ਤੁਹਾਨੂੰ ਪਤਾ ਹੋਣਾ ਤੁਸੀਂ ਕਾਫੀ ਟਾਈਮ ਤੋਂ ਰਹਿੰਦੇ ਹਾਂਜੀ ਹਾਂਜੀ ਮਤਲਬ ਛੋਟੇ ਬੱਚੇ ਵਾਸਤੇ ਵੈਸੇ ਜ਼ਿਆਦਾ ਕਿਹੜਾ ਸਕੂਲ ਬੈਸਟ ਰਹੇਗਾ ਹਾਂਜੀ ਓਕੇ ਭਾਅ ਜੀ ਅਤੇ ਫੀਸ ਵਗੈਰਾ ਕੁਛ ਦੱਸ ਸਕਦੇ ਹੋ ਆਈਡੀਆ ਹਾਂਜੀ ਓਕ ਹਾਂਜੀ ਓਕੇ ਥੈਂਕ ਯੂ ਭਾਅ ਜੀ ਹਾਂਜੀ ਬਹੁਤ ਬਹੁਤ ਧੰਨਵਾਦ